ਸਾਡੇ ਮੋਹਾਲੀ ਜ਼ਿਲ੍ਹੇ ਦੇ ਵਿੱਚ ਬਹੁਤ ਸਾਰੇ ਤਿਉਹਾਰ ਆ ਜਿਹੜੇ ਮਨਾਏ ਜਾਂਦੇ ਆ ਪਰ ਜਿਵੇਂ ਦੀਵਾਲੀ ਹੋਲੀ ਹੋ ਗਿਆ ਇਹਨਾਂ ਨੂੰ ਲੋਕ ਧੂਮ ਧਾਮ ਦੇ ਨਾਲ ਮਨਾਉਂਦੇ ਹੈ ਦੀਵਾਲੀ ਵਾਲੇ ਦਿਨ ਤੋਂ ਹੀ ਦੀਵਾਲੀ ਵਾਲੇ ਦਿਨ ਆਉਣ ਤੋਂ ਪਹਿਲਾਂ ਹੀ ਲੋਕ ਜੋ ਦੀਵਾਲੀ ਦੀ ਸਫਾਈਆਂ ਆ ਉਹ ਦਿਨ ਦੀਆਂ ਤਿਆਰੀਆਂ ਆ ਉਹ ਸ਼ੁਰੂ ਕਰ ਦਿੰਦੇ ਆ ਦੀਵਾਲੀ ਵਾਲੇ ਦਿਨ ਲੋਕ ਨਵੇਂ ਨਵੇਂ ਕੱਪੜੇ ਪਾਉਂਦੇ ਹੈ ਅਤੇ ਆਪਣੇ ਘਰਾਂ ਨੂੰ ਚਮਕਾਉਂਦੇ ਹੈ ਆਪਣੇ ਘਰਾਂ ਦੇ ਵਿੱਚ ਰੰਗੋਲੀਆਂ ਬਣਾਉਂਦੇ ਹੈ ਅਤੇ ਲੋਕ ਹੈ ਜੋ ਉਹ ਇੱਥੇ ਧਾਰਮਿਕ ਸਥਾਨਾਂ 'ਤੇ ਜਾਣਾ ਜ਼ਿਆਦਾ ਪਸੰਦ ਕਰਦੇ ਆ ਜਿਵੇਂ ਕਈ ਲੋਕ ਹੈ ਜੋ ਸਿੱਖ ਧਰਮ ਦੇ ਆ ਉਹ ਗੁਰਦੁਆਰਿਆਂ ਵਿੱਚ ਜਾਣਾ ਪਸੰਦ ਕਰਦੇ ਆ ਜੋ ਹੋਰ ਹੋਰ ਧਰਮਾਂ ਦੇ ਲੋਕ ਆ ਉਹ ਆਪਣੇ ਆਪਣੇ ਧਾਰਮਿਕ ਸਥਾਨਾਂ 'ਤੇ ਜਾਣਾ ਪਸੰਦ ਕਰਦੇ ਹੈ ਅਤੇ ਦੀਵਾਲੀ ਵਾਲੇ ਦਿਨ ਬਾਜ਼ਾਰ ਹੈ ਜੋ ਸਜੇ ਹੁੰਦੇ ਹੈ ਅਤੇ ਲੋਕ ਹੈ ਜੋ ਉ ਉਹ ਵ ਨਵੇਂ ਨਵੇਂ ਕੱਪੜੇ ਪਾ ਕੇ ਅਤੇ ਬਾਜ਼ਾਰਾਂ ਦੇ ਵਿੱਚੋਂ ਪਟਾਕੇ ਹੋ ਗਏ ਅਤੇ ਆਪਣੇ ਘਰ ਨੂੰ ਸਜਾਉਣ ਦੇ ਲਈ ਜੋ ਜੋ ਉਹਨਾਂ ਨੂੰ ਲੋੜਵੰਦ ਚੀਜ਼ਾਂ ਹੁੰਦੀਆਂ ਉਹਨਾਂ ਨੂੰ ਖਰੀਦਣ ਦੇ ਲਈ ਜਾਂਦੇ ਹੈ ਅਤੇ ਲੋਕ ਮਿਠਾਈਆਂ ਖਰੀਦਦੇ ਹੈ ਅਤੇ ਇੱਕ ਦੂਜੇ ਨੂੰ ਮਿਠਾਈਆਂ ਦਿੰਦੇ ਹੈ ਅਤੇ ਦੀਵਾਲੀ ਵਾਲੇ ਦਿਨ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੈ ਅਤੇ ਜ ਲੋਕ ਇਸ ਦਿਨ ਜੋ ਸ਼ਾਮ ਨੂੰ ਹੈ ਉਹ ਲੋਕ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਜਿਵੇਂ ਮੋਮਬੱਤੀਆਂ ਲਗਾਉਂਦੇ ਹੈ ਅਤੇ ਮੱਥਾ ਟੇਕਦੇ ਹੈ ਅਤੇ ਅਰਦਾਸ ਕਰਦੇ ਹੈ ਜੋ ਸ ਹਿੰਦੂ ਪਰਿਵਾਰਾਂ ਦੇ ਵਿੱਚ ਜਿਹੜੀ ਲਕਸ਼ਮੀ ਮਾਤਾ ਦੀ ਪੂਜਾ ਕਰੀ ਜਾਂਦੀ ਹੈ ਸ ਅ ਦੀਵਾਲੀ ਵਾਲੇ ਦਿਨ 'ਤੇ ਲੋਕ ਪਟਾਕੇ ਚਲਾਉਂਦੇ ਹੈ ਅਤੇ ਖੁਸ਼ੀ ਖੁਸ਼ੀ ਆਪਣਾ ਜੋ ਤਿਉਹਾਰ ਦਾ ਵਾਲਾ ਦਿਨ ਆ ਉਹਨੂੰ ਮਨਾਉਂਦੇ ਹੈ ਅਤੇ ਲੋਕ ਸ਼ੁਭਕਾਮਨਾਵਾਂ ਦਿੰਦੇ ਹੈ ਇੱਕ ਦੂਜੇ ਨੂੰ ਕਿ ਹ ਜਿਵੇਂ ਇਹ ਦ ਦ ਦੀਵਾਲੀ ਦਾ ਤਿਉਹਾਰ ਆ ਜੋ ਰੌਸ਼ਨੀਆਂ ਦਾ ਤਿਉਹਾਰ ਹੈ ਅਤੇ ਸਭ ਦੀ ਜ਼ਿੰਦਗੀ ਦੇ ਵਿੱਚ ਰੌਸ਼ਨੀ ਹੀ ਭਰ ਦੇਵੇ